ਗਿਆਰ੍ਹਾਂ ਜਨਵਰੀ ਉੱਨੀ ਸੌ ਇਕਹੱਤਰ ਅਠਾਈ ਨਵੰਬਰ ਉੱਨੀ ਸੌ ਪਝੱਤਰ ਛੇ ਦਸੰਬਰ ਉੱਨੀ ਸੌ ਅਠਾਨਵੇਂ ਛੱਬੀ ਮਈ ਦੋ ਹਜ਼ਾਰ ਅਠਾਰਾਂ ਜਨਵਰੀ ਦੋ ਹਜ਼ਾਰ ਤਿੰਨ